ਮੈਂ ਮੱਧ ਪੀੜ੍ਹੀ ਦਾ ਹਿੱਸਾ ਨਹੀਂ ਹਾਂ ਮੈਂ ਨੌਜਵਾਨ ਪੀੜ੍ਹੀ ਦਾ ਹਿੱਸਾ ਹਾਂ ਮੈਂ ਇਹ ਅਨੁਭਵ ਕੀਤਾ ਹੈ ਕਿ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਵਿੱਚ ਸਮਾਨਤਾ ਇਹ ਹੈ ਕਿ ਇਹ ਇੱਕ ਦੂਜੇ ਨਾਲ ਰਹਿੰਦੀ ਹੈ ਅਤੇ ਮੱਧ ਪੀੜ੍ਹੀ ਆਪਣੇ ਕੰਮ ਕਾਰ ਵਿੱਚ ਵਿਅਸਤ ਹੋ ਜਾਂਦੀ ਹੈ ਅਤੇ ਉਹ ਆਪਣੇ ਨੌ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਨੂੰ ਸਮਾਂ ਨਹੀਂ ਦੇ ਪਾਉਂਦੇ ਅਤੇ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਇੱਕ ਦੂਜੇ ਨਾਲ ਸਮਾਂ ਬਤੀਤ ਕਰਦੇ ਹਨ ਇਹ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਹਨ ਅਤੇ ਇੱਕ ਦੂਜੇ ਦਾ ਖਿਆਲ ਰੱਖਦੇ ਹਨ ਰੋਟੀ ਪਾਣੀ ਵੀ ਪੁੱਛਦੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ ਕਹਿੰਦੇ ਹਨ ਕਿ ਪੁਰਾਣੀ ਅਤੇ ਨੌਜਵਾਨ ਪੀੜ੍ਹੀ ਵਿੱਚ ਦਾਦਾ ਆਪਣੇ ਪੋਤਰੇ ਦਾ ਪਹਿਲਾ ਦੋਸਤ ਹੁੰਦਾ ਹੈ ਅਤੇ ਪੋਤਰਾ ਆਪਣੇ ਦਾਦੇ ਦਾ ਆਖਰੀ ਦੋਸਤ ਹੁੰਦਾ ਹੈ ਉੱਦਾਂ ਹੀ ਦਾਦੀ ਆਪਣੇ ਪੋਤਰੀ ਦੀ ਪਹਿਲੀ ਦੋਸਤ ਹੁੰਦੀ ਹੈ ਅਤੇ ਪੋਤਰੀ ਆਪਣੀ ਦਾਦੀ ਦੀ ਆਖਰੀ ਦੋਸਤ ਹੁੰਦੀ ਹੈ ਇਹਨਾਂ ਵਿੱਚ ਇਹ ਸਮਾਨਤਾ ਹੈ ਅਤੇ ਇਹਨਾਂ ਵਿੱਚ ਅੰਤਰ ਵੀ ਬਹੁਤ ਹਨ ਜਿਵੇਂ ਕਿ ਪੁਰਾਣੀ ਪੀੜ੍ਹੀ ਗੁਰਬਾਣੀ ਸੁਣਨਾ ਅਤੇ ਕਥਾ ਸੁਣਨਾ ਪਸੰਦ ਕਰਦੀ ਹੈ ਅਤੇ ਨੌਜਵਾਨ ਪੀੜ੍ਹੀ ਗਾਣੇ ਸੁਣਨਾ ਅਤੇ ਫੋਨ 'ਤੇ ਲੱਗੇ ਰਹਿਣਾ ਪਸੰਦ ਕਰਦੀ ਹੈ ਅਤੇ ਪੁਰਾਣੀ ਪੀੜ੍ਹੀ ਜਲਦੀ ਉੱਠ ਕੇ ਗੁਰਦੁਆਰੇ ਜਾਣਾ ਪਸੰਦ ਕਰਦੇ ਹੈ ਅਤੇ ਨੌਜਵਾਨ ਪੀੜੀ ਲੇਟ ਉਠਣਾ ਪਸੰਦ ਕਰਦੀ ਹੈ